ਸੱਤ ਮਾਰਚ ਦੋ ਹਜ਼ਾਰ ਪੰਜ ਛੇ ਮਈ ਦੋ ਹਜ਼ਾਰ ਸੌਲ੍ਹਾਂ ਅੱਠ ਅਪ੍ਰੈਲ ਦੋ ਹਜ਼ਾਰ ਸਤਾਰ੍ਹਾਂ ਨੌਂ ਮਈ ਦੋ ਹਜ਼ਾਰ ਪੰਦਰ੍ਹਾਂ ਫਿਰ ਦਸ ਦਿਸੰਬਰ ਦੋ ਹਜ਼ਾਰ ਉੱਨੀ